ਵੀਰ ਜੀ ਮੇਰੇ ਕੋਲ ਖੁੱਲ੍ਹੇ ਪੈਸੇ ਨਹੀਂ ਹਨ ਕੀ ਮੈਂ ਤੁਹਾਨੂੰ ਕਿਰਾਇਆ ਯੂ ਪੀ ਆਈ ਆਈ ਡੀ ਰਾਹੀਂ ਭੁਗਤਾਨ ਕਰ ਦੇਵਾਂ ਕੀ ਤੁਸੀਂ ਫੋਨਪੇ ਗੂਗਲ ਪੇ ਜਾਂ ਪੇਟੀਐਮ ਚਲਾਉਂਦੇ ਹੋ ਮੈਨੂੰ ਆਪਣਾ ਸਕੈਨਰ ਦੇ ਦਿਓ ਜਾਂ ਮੋਬਾਇਲ ਨੰਬਰ ਦੇ ਦਿਓ